ਹਾਂਜੀ ਜਿਹੜੀ ਬਾਗਬਾਨੀ ਹੈਗੀ ਹੈ ਉਹ ਰੂਟੀਨ 'ਚ ਕੰਪੋਸਟਿੰਗ ਦੀ ਭੂਮਿਕਾ ਵੀ ਨਿਭਾਉਂਦੀ ਹੈ ਕਿਉਂਕਿ ਘਰ 'ਚ ਆਪਾਂ ਰੋਜ਼ ਸਬਜ਼ੀਆਂ ਵੀ ਛਿੱਲਣੀਆਂ ਚਾਹ ਵੀ ਰੋਜ਼ ਬਣਾਉਣੀ ਪੱਤੀ ਵਗੈਰਾ ਜੋ ਵੀ ਕੁਛ ਹੁੰਦਾ ਮੈਂ ਕੰਪੋਸਟਿੰਗ ਲਈ ਬਾਲਟੀ ਲਗਾਈ ਹੋਈ ਆ ਉਹਦੇ ਵਿੱਚ ਉਹ ਸਾਰੇ ਪਾ ਦਿੰਦੀ ਹਾਂ ਅਤੇ ਪਰ ਜਿਹੜਾ ਫਰੂਟਸ ਵਗੈਰਾ ਛਿਲਕੇ ਸਬਜ਼ੀਆਂ ਦੇ ਛਿਲਕੇ ਹੁੰਦੇ ਆ ਇਹਦੇ ਨਾਲ ਸਮੈੱਲ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਮੈਂ ਉੱਪਰ ਛੱਤ 'ਤੇ ਲਗਾਈ ਹੋਈ ਹੈ ਬਾਲਟੀ ਉਹਦੇ ਵਿੱਚ ਇਕੱਠਾ ਕਰਦੇ ਹਾਂ ਉਹ ਕੰਪੋਸਟਿੰਗ ਕਰਨ ਨਾਲ ਉਹ ਜਿਹੜੀ ਖਾਦ ਤਿਆਰ ਹੋ ਜਾਂਦੀ ਹੈਗੀ ਉਹਨੂੰ ਬੂਟਿਆਂ 'ਚ ਪਾਉਂਦੇ ਆਪਾਂ ਉਹ ਜਿਹੜੀ ਰੈਡੀਮੇਡ ਸਪਰੇਅ ਦੇ ਨਾਲੋਂ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਅਤੇ ਉਹਦੇ ਨਾਲ ਬੂਟੇ ਵੀ ਵਧੀਆ ਗਰੋਅ ਕਰਦੇ ਹੈ ਅਤੇ ਨਾਲੇ ਝਾੜ ਵੀ ਵਧੀਆ ਹੁੰਦਾ ਫਲ ਵਗੈਰਾ ਵਧੀਆ ਪੈਂਦਾ ਅਤੇ ਨਾਲੇ ਬਣ ਖਾਦ ਆਪਾਂ ਨੂੰ ਘਰੇ ਜਿਹੜਾ ਵੇਸਟ ਮਟੀਰੀਅਲ ਆਪਾਂ ਛਿੱਲੜ ਲਾਹ ਕੇ ਸੁੱਟੇ ਹੁੰਦੇ ਆ ਸਬਜ਼ੀਆਂ ਫਰੂਟਾਂ ਦੇ ਉਹਦੇ ਤੋਂ ਵੀ ਬਹੁਤ ਵਧੀਆ ਖਾਦ ਤਿਆਰ ਹੋ ਜਾਂਦੀ ਹੈਗੀ ਅਤੇ ਇਹਦੇ ਨਾਲ ਜ਼ਿਆਦਾ ਵਧੀਆ ਮਤਲਬ ਬੂਟੇ ਵਧੀਆ ਸੋਹਣੀ ਮਤਲਬ ਗਰੋਥ ਕਰਦੇ ਆ ਉਹ